ਪੰਜਾਬ ਦੇ ਬਹੁਤ ਹੀ ਪ੍ਰਮੁੱਖ ਧਾਰਮਿਕ ਤਿਉਹਾਰ ਹਨ ਇਹਨਾਂ ਦੇ ਵਿੱਚ ਗੁਰਪੁਰਬ ਆ ਜਾਂਦੇ ਨੇ ਦਿਵਾਲੀ ਦਾ ਤਿਉਹਾਰ ਹੈ ਦੁਸਹਿਰੇ ਦਾ ਹੈ ਹਰ ਧਰਮ ਨਾਲ ਜੁੜੇ ਹੋਏ ਕਾਫ਼ੀ ਤਿਉਹਾਰ ਮਨਾਏ ਜਾਂਦੇ ਨੇ ਸਿੱਖ ਧਰਮ ਦੇ ਵਿੱਚ ਸਾਡੇ ਦਸਾਂ ਗੁਰੂਆਂ ਸਾਹਿਬਾਂ ਦੇ ਜਿੰਨੇ ਵੀ ਗੁਰਪੁਰਬ ਦਿਨ ਆਉਂਦੇ ਉਹ ਹਰ ਸਿੱਖ ਧਰਮ ਦੇ ਲੋਕ ਇਸ ਨੂੰ ਬੜੇ ਹੀ ਧੂਮ ਧਾਮ ਨਾਲ ਮਨਾਉਂਦੇ ਹਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਆਉਂਦਾ ਉਸਦੇ ਦਿਨ ਨਗਰ ਕੀਰਤਨ ਨਿਕਲਦਾ ਹੈ ਪੂਰੇ ਪੰਜਾਬ ਦੇ ਵਿੱਚ ਹਰ ਥਾਂ ਦੇ ਵਿੱਚ ਨਗਰ ਕੀਰਤਨ ਦੇ ਦੌਰਾਨ ਯਾਤਰਾ ਕੱਢੀ ਜਾਂਦੀ ਹੈ ਉਸ ਤੋਂ ਬਾਅਦ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਹਰ ਸਾਲ ਹਰ ਪੂਰੇ ਪੰਜਾਬ ਦੇ ਨਾਲ ਨਾਲ ਇੰਡੀਆ ਦੇ ਵਿੱਚ ਹੀ ਨਹੀਂ ਪੂਰੇ ਵਿਸ਼ਵ ਭਰ ਦੇ ਵਿੱਚ ਜਿੱਥੇ ਵੀ ਸਿੱਖ ਸੰਗਤ ਰਹਿੰਦੀ ਹੈ ਪੂਰੇ ਵਰਲਡ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਬੜੇ ਹੀ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ ਉਸ ਤੋਂ ਬਾਅਦ ਗੱਲ ਦਿਵਾਲੀ ਦੀ ਕਰਦੇ ਹਾਂ ਦਿਵਾਲੀ ਹਰ ਰਿਲੀਜ਼ਨ ਦੇ ਲੋਕ ਮਨਾਉਂਦੇ ਹਨ ਹਿੰਦੂ ਧਰਮ ਦੇ ਵਿੱਚ ਵੀ ਇਸ ਦੀ ਬਹੁਤ ਹੀ ਮਹੱਤਤਾ ਹੈ ਸਿੱਖ ਧਰਮ ਦੇ ਵਿੱਚ ਵੀ ਦਿਵਾਲੀ ਵਾਲੇ ਦਿਨ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਨੇ ਗਵਾਲੀਅਰ ਤੋਂ ਬਵੰਜਾ ਰਾਜਿਆਂ ਨੂੰ ਛੁ ਛੁਡਵਾ ਕੇ ਲਿਆਂਦਾ ਸੀ ਔਰ ਬੰਦੀ ਦਿਵਸ ਮਨਾਇਆ ਜਾਂਦਾ ਹੈ ਦਿਵਾਲੀ ਅੱਜ ਦੇ ਸਮੇਂ ਦੇ ਵਿੱਚ ਪੂਰੇ ਭਾਰਤ ਦਾ ਪ੍ਰਮੁੱਖ ਤਿਉਹਾਰ ਹੈ ਉਸ ਤੋਂ ਬਾਅਦ ਦੁਸ਼ਹਿਰਾ ਵੀ ਪੂਰੇ ਭਾਰਤ ਦੇ ਵਿੱਚ ਹੀ ਮਨਾਇਆ ਜਾਂਦਾ ਹੈ ਈਦ ਈਦ ਵੀ ਸਾਡੇ ਪੂਰੇ ਭਾਰਤ ਦੇ ਵਿੱਚ ਮੁਸਲਮਾਨ ਨਾਲ ਸੰਬੰਧਿਤ ਕਮਿਊਨਿਟੀ ਦੇ ਲੋਕ ਈਦ ਵੀ ਮਨਾਉਂਦੇ ਹੈ ਹੋਲੀ ਦਾ ਤਿਉਹਾਰ ਵੀ ਪੂਰੇ ਭਾਰਤ ਦੇ ਵਿੱਚ ਮਨਾਇਆ ਜਾਂਦਾ ਹੈ ਇਹ ਖਾਸਕਰ ਨੌਰਥ ਇੰਡੀਆ ਦਾ ਪ੍ਰਮੁੱਖ ਤਿਉਹਾਰ ਹੈ ਯੂ ਪੀ ਬਿਹਾਰ ਦੇ ਲੋਕ ਇਸ ਨੂੰ ਬਹੁਤ ਹੀ ਚਾਵਾਂ ਨਾਲ ਮਨਾਉਂਦੇ ਹੈ ਔਰ ਇਸ ਦਿਨ ਦੀ ਲੰਬੀ ਉਡੀਕ ਰੱਖਦੇ ਹਨ ਅਤੇ ਰੱਖੜੀ ਦੇ ਤਿਉਹਾਰ ਵੀ ਪੂਰੇ ਭਾਰਤ ਦੇ ਵਿੱਚ ਮਨਾਇਆ ਜਾਂਦਾ ਹੈ ਇਸਦਾ ਵੀ ਤਿਉਹਾਰ ਅਤੇ ਵੀ ਹਰ ਇਨਸਾਨ ਹਰ ਵਰਗ ਇਸਦੀ ਡੇਟ ਉਡੀਕ ਕਰਦਾ ਹੈ ਅਤੇ ਇਸ ਤ ਤਿਉਹਾਰ ਇਹਨਾਂ ਤਿਉਹਾਰਾਂ ਨੂੰ ਬਹੁਤ ਹੀ ਜਾਣੀ ਧੂਮ ਧਾਮ ਨਾਲ ਮਨਾਉਂਦੇ ਹਨ ਜੀ